ਹੈਲੋ ਗੁਡ ਮੋਰਨਿੰਗ ਮੈਮ ਮੈਮ ਆਪ ਐਲਾਸੀ ਐਲ ਆਈ ਸੀ ਸੇ ਬੋਲ ਰਹੇ ਹੋ ਅੱਛਾ ਹਾਂਜੀ ਮੈਮ ਅਸੀਂ ਥੋੜ੍ਹੀ ਜਿਹੀ ਐਲ ਆਈ ਸੀ ਕਰਵਾਉਣੀ ਸੀਗੀ ਹੈਲਥ ਇਨਸ਼ੋਰੈਂਸ ਅਤੇ ਤੁਸੀਂ ਮੈਨੂੰ ਦੱਸੋਗੇ ਕਿ ਕੀ ਪ੍ਰੋਸੀਜਰ ਇਸ ਚੀਜ਼ ਦਾ ਹੈ ਹਾਂਜੀ ਉਹ ਨਾ ਹੈਲਥ ਇੰਸ਼ੋਰੈਂਸ ਹੀ ਕਰਵਾਉਣੀ ਸੀਗੀ ਹਾਂਜੀ

ਅੱਛਾ ਜੀ ਅਛ ਅੱਛਾ ਠੀਕ ਹੈ ਜੀ ਹਾਂਜੀ ਅੱਛਾ ਜੀ ਠੀਕ ਹੈ ਜੀ ਹਾਂਜੀ

ਠੀਕ ਹੈ ਜੀ ਹਾਂਜੀ ਅਤੇ ਇਹ ਇਹ ਮੈਡਮ ਇਕੱਲੇ ਬੰਦੇ ਦਾ ਹੈ ਕਿ ਫੁੱਲ ਫੈਮਲੀ ਦਾ ਕਰਵਾ ਸਕਦੇ ਹਾਂ ਅਸੀਂ ਅੱਛਾ ਜੀ ਅਤੇ ਫੁੱਲ ਪੈਕਿਜ ਫੁਲ ਫੈਮਲੀ ਦਾ ਕੀ ਪੈਕੇਜ ਆ

ਠੀਕ ਹੈ ਜੀ ਅਤੇ ਇਸ 'ਚ ਕੋਈ ਡਿਸਕਾਊਂਟ ਨਹੀਂ ਹੁੰਦਾ ਹਾਂਜੀ ਕਿੰਨਾ ਹੁੰਦਾ ਮੈਮ ਅੱਛਾ ਜੀ ਅੱਛਾ ਅਤੇ ਇਹ ਜਦੋ ਆਪਾਂ ਜਦੋਂ ਐਲ ਆਈ ਸੀ ਕਰਵਾਉਣੀ ਹੈ ਅਤੇ ਅਸੀਂ ਤੁਹਾਡੇ ਆਫਿਸ ਆਈਏ ਕਿ ਤੁਸੀਂ ਸਾਡੇ ਘਰ ਵਿਜਿਟ ਕਰੋਗੇ ਓਕੇ ਜੀ ਕਦੋਂ ਤੋਂ ਕਦੋਂ ਤੱਕ ਓ ਅੱਛਾ ਜੀ ਕਦੋਂ ਅਤੇ ਆਫਿਸ ਖੁੱਲਦਾ ਤੁਹਾਡਾ ਕਿੰਨੀ ਟਾਈਮਿੰਗ ਹੈ ਠੀ ਠੀਕ ਹੈ ਜੀ ਅਤੇ ਤੁਹਾਡਾ ਆਫਿਸ ਕਿੱਥੇ ਆ ਅੱਛਾ ਜੀ ਅੱਛਾ ਠੀਕ ਠੀਕ ਹੈ ਕਿੱਥੇ ਕਰਕੇ

ਓ ਓਕੇ ਥੈਂਕ ਯੂ ਧੰਨਵਾਦ